ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਰੁਪਿੰਦਰ ਕੌਰ ਹਾਂ ਅਤੇ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਸਰ ਮੈਨੂੰ ਮੇਰੇ ਕਿਸੇ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਹੈ ਕਿ ਮੈਨੂੰ ਕੈਬ ਦੀ ਜ਼ਰੂਰਤ ਸੀ ਤਾਂ ਮੈਨੂੰ ਮੇਰੇ ਕਿਸੇ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਜਿਹਦੇ ਕਰਕੇ ਮੈਨੂੰ ਤੁਹਾਨੂੰ ਮਤਲਬ ਕੋਲ ਕਰਨਾ ਸਹੀ ਲੱਗਾ ਸੋ ਸਰ ਮੈਂ ਅਤੇ ਮੇਰੇ ਨਾਲ ਪੰਜ ਮੇਰੇ ਸਾਥੀ ਹਨ ਅਸੀਂ ਸਭ ਨੇ ਅਠਾਰਾਂ ਦੋ ਦੋ ਹਜ਼ਾਰ ਚੌਵੀ ਨੂੰ ਸਵੇਰੇ ਨੌ ਵਜੇ ਅੰਮ੍ਰਿਤਸਰ ਤੋਂ ਜਲੰਧਰ ਬਹੁਤ ਹੀ ਇੰਮਪੋਰਟੈਂਟ ਫੰਕਸ਼ਨ ਹੈ ਜੋ ਕਿ ਅਟੈਂਡ ਕਰਨਾ ਹੈ ਅਸੀਂ ਸੋ ਅਸੀਂ ਅੰਮ੍ਰਿਤਸਰ ਤੋਂ ਜਲੰਧਰ ਜਾਣਾ ਹੈ ਤੋ ਕਿਰਪਾ ਕਰਕੇ ਪਲੀਜ਼ ਮੈਂ ਤੁਹਾਨੂੰ ਆਪਣਾ ਕੈ ਮੈਂ ਤੁਹਾਡੀ ਕੈਬ ਬੁੱਕ ਕਰਨਾ ਚਾਹੁੰਦੀ ਹਾਂ ਜਿਹਦੇ ਕਿ ਜਿਹਦੇ ਲਈ ਕਿ ਮੈਨੂੰ ਮੇਰੇ ਜ ਮੇਰੇ ਕਿਸੇ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਹੈ ਸੋ ਸਰ ਕਿਰਪਾ ਕਰਕੇ ਕੀ ਤੁਸੀਂ ਮੈਨੂੰ ਸਵੇਰੇ ਨੌ ਵਜੇ ਤੱਕ ਅੰਮ੍ਰਿਤਸਰ ਤੋਂ ਮੇਰੇ ਫਰੈਂਡਸ ਦੇ ਨਾਲ ਪਿਕ ਕਰ ਸਕਦੇ ਹੋ ਸੋ ਪਲੀਜ਼ ਨੋਟ ਡ ਨੋਟ ਡਾਊਨ ਕਰ ਲਓ ਮੇਰਾ ਕੋਂਟੈਕਟ ਐਂਡ ਮੇਰਾ ਟਾਈਮ ਐਂਡ ਮੇਰੀ ਡੇਟ ਉਹਦੇ ਅਕੋਡਿੰਗ ਪਲੀਜ਼ ਤੁਸੀਂ ਸਵੇਰੇ ਨੌ ਵਜੇ ਮੈਨੂੰ ਅੰਮ੍ਰਿਤਸਰ ਤੋਂ ਪਿਕ ਕਰ ਲੈਣਾ ਸੋ ਮੇਰੇ ਨਾਲ ਜਿੰਨੇ ਵੀ ਜਾਣੇ ਹੈ ਨਾ ਸਾਰੇ ਟਾਈਮ ਨਾਲ ਪਹੁੰਚ ਸਕੇ ਓਕੇ ਸਰ ਥੈਂਕ ਯੂ